ਹੈਲੋ ਸਤਿ ਸ਼੍ਰੀ ਅਕਾਲ ਸਰ ਮੈਂ ਕਰਮਵੀਰ ਬੋਲਣ ਡਿਆ ਸਰ ਸਰ ਅਸੀਂ ਤੁਹਾਡੇ ਕੋਲ ਆਡਰ ਕਰਵਾਇਆ ਸੀ ਦੋ ਤਿੰਨ ਦਿਨ ਹੋ ਗਏ ਸਬਵੇਅ ਤੋਂ ਅਤੇ ਮਤਲਬ ਵੀ ਸਾਡੇ ਘਰ ਅਸੀਂ ਆਡਰ ਪਹੁੰਚਿਆ ਨਹੀਂ ਹੈ ਤੁਹਾਡਾ ਅਤੇ ਅਸੀਂ ਮਤਲਬ ਵੀ ਘਰ ਮਹਿਮਾਨ ਸਾਡੇ ਆਏ ਹੋਏ ਆ ਹਾਂਜੀ ਅਤੇ ਨਾ ਤੁਹਾਡੇ ਮਲਕਿ ਇੱਥੋਂ ਵਾਲੇ ਫੋਨ ਹੀ ਚੁੱਕ ਰਹੇ ਸਾਡਾ ਅਤੇ ਨਾ ਸਾਨੂੰ ਕੁਝ ਦੱਸ ਰਹੇ ਆ ਵੀ ਕੀ ਗੱਲ ਆ ਕੀ ਬਾਤ ਆ ਨਹੀਂ ਅਤੇ ਇਹ ਆ ਵੀ ਕਿਰਪਾ ਕਰਕੇ ਨਾ ਸਾਨੂੰ ਜਿਹੜਾ ਸਾਡਾ ਅਸੀਂ ਆਡਰ ਦਿੱਤਾ ਵਾ ਉਹਦੇ ਵਿੱਚ ਅਸੀਂ ਕੋਲਡਰਿੰਕ ਬੁੱਕ ਕਰਵਾਈ ਸੀ ਕੁਝ ਪੀਜ਼ਾ ਕਰਵਾਇਆ ਸੀ ਕੁਝ ਸਾਡੀਆਂ ਪੈਟੀਆਂ ਸੀ ਅਤੇ ਮਤਲਬ ਕਿ ਹੋਰ ਵੀ ਇੱਕ ਦੋ ਖਾਣ ਵਾਲੀਆਂ ਐਟਮਾਂ ਤੁਹਾਨੂੰ ਬੁੱਕ ਕਰਵਾਈਆਂ ਸੀ ਅਤੇ ਉਹ ਸਾਡੇ ਘਰ ਅਜੇ ਤੱਕ ਕੋਈ ਵੀ ਨਹੀਂ ਪਹੁੰਚੀ ਇਹ ਕਿਉਂ ਇੰਨੀ ਦੇਰ ਹੋ ਰਹੀ ਹੈ ਕੀ ਕਾਰਨ ਅਸੀਂ ਤਾਂ ਪੇਮੈਂਟ ਵੀ ਜਿਹੜੀ ਤੁਹਾਨੂੰ ਪਹਿਲਾਂ ਕਰ ਚੁੱਕੇ ਹਾਂ ਅਤੇ ਪੇਮੈਂਟ ਕਰਨ ਤੋਂ ਪਹਿਲਾਂ ਹੀ ਕਰਕੇ ਅਤੇ ਤੁਹਾਨੂੰ ਦੱਸ ਦਿੱਤਾ ਸੀ ਵੀ ਚਲੋ ਸਾਨੂੰ ਇਸ ਟੈਮ ਨਾਲ ਚੀਜ਼ ਪਹੁੰਚ ਜਾਵੇ ਤੁਹਾਨੂੰ ਸੱਤ ਵਜੇ ਦਾ ਅਸੀਂ ਆਡਰ ਦਿੱਤਾ ਹੋਇਆ ਸੀ ਜਿਹੜਾ ਕਿ ਉਹ ਹੁਣ ਨੌਂ ਵੱਜ ਚੁੱਕੇ ਆ ਅਤੇ ਤੁਹਾਡਾ ਅਜੇ ਤੱਕ ਸਾਨੂੰ ਕੋਈ ਆਡਰ ਨਹੀਂ ਪਹੁੰਚਿਆ